ਹੈਲੋ ਸੁਨੀਤਾ ਬੱਚੇ ਕਿਵੇਂ ਹੋ ਨਮਸਤੇ ਨਮਸਤੇ ਅਤੇ ਤੁਸੀਂ ਮੈਂ ਦੇਖੀਆਂ ਆ ਤੁਹਾਡੀਆਂ ਵਟਸਅੱਪ ਦੇ ਵਿੱਚ ਤੁਸੀਂ ਫੋਟੋ ਵਗੈਰਾ ਲਗਾਈਆਂ ਹੋਈਆਂ ਸੀ ਆ ਆਪਣੇ ਫੈਸਟੀਵਲ ਦੀਆਂ ਜਿਹੜਾ ਤੁਸੀਂ ਡੇਸ ਵਾਲਾ ਮਨਾਇਆ ਸੀ ਸ਼ਾਇਦ ਹਨਾ ਤੇ ਉਹ ਕਿੱਦਾਂ ਰਿਹਾ ਤੁਹਾਡਾ ਵੈਸੇ ਹਾਂ ਹਾਂ ਹਾਂ ਹਾਂ ਹਾਂ ਅੱਛਾ ਵੈਲਕਮ ਵੈਲਕਮ ਬੇਟਾ ਇਹ ਮੈਂ ਦੇਖਿਆ ਵੀ ਤੁਸੀਂ ਅ ਮਤਲਬ ਐਂਕਰਿੰਗ ਕੀਤੀ ਸੀਗੀ ਅਤੇ ਵਧੀਆ ਕੀਤੀ ਸੀ ਅਤੇ ਤੁਹਾਡੇ ਨਾਲ ਕੁਛ ਫਰੈਂਡ ਵੀ ਸੀਗੇ ਹੈ ਨਾ ਜਿਹੜੇ ਤੁਹਾਡੇ ਨਾਲ ਸੀ ਅਤੇ ਤੁਸੀਂ ਮਤਲਬ ਇਕੱਠੇ ਰਹਿੰਦੇ ਹੋ ਸਾਰੇ ਬੱਚੇ ਜਿਹੜੇ ਤੁਸੀਂ ਫੋਟੋ ਖਿਚਾਈ ਹੋਈ ਸੀ ਜਿਹਨਾਂ ਦੇ ਨਾਲ

ਅੱਛਾ ਅੱਛਾ ਅੱਛਾ ਅਤੇ ਮੈਨੂੰ ਇੱਦਾਂ ਦੱਸੋ ਵੀ ਤੁਹਾਡੀ ਫਿਰ ਹੋਸਟਲ ਲਾਈਫ ਕਿੱਦਾਂ ਚੱਲ ਰਹੀ ਹੈ ਤੁਸੀਂ ਹੁਣ ਕਾਫੀ ਮੈਨੂੰ ਲੱਗਦਾ ਤੁਸੀਂ ਦੋ ਮਹੀਨੇ ਤੋਂ ਘਰੇ ਹੀ ਨਹੀਂ ਆਏ ਹੁਣ ਹੁਣ ਤੁਸੀਂ ਕਦੋਂ ਆਉਣਾ ਵੈਸੇ

ਅੱਛਾ ਅੱਛਾ ਅੱਛਾ ਅ ਮੈਂ ਵੀ ਤੈਨੂੰ ਦੱਸਾਂ ਜਦੋਂ ਮੈਂ ਪੜ੍ਹਦਾ ਹੁੰਦਾ ਸੀ ਮੈਂ ਵੀ ਹੋਸਟਲ ਦੇ ਵਿੱਚ ਰਿਹਾ ਜਦੋਂ ਮੈਨੂੰ ਮੇਰੇ ਘਰਦਿਆਂ ਨੇ ਹੋਸਟਲ ਵਿੱਚ ਭੇਜਤਾ ਸੀ ਅਤੇ ਸ਼ੁਰੂ ਸ਼ੁਰੂ ਵਿੱਚ ਮੈਨੂੰ ਲੱਗਿਆ ਸੀਗਾ ਇੱਦਾਂ ਵੀ ਮੈਂ ਸ਼ਾਇਦ ਹੋਸਟਲ 'ਚ ਨਾ ਰਹਿ ਪਾਵਾਂ ਅਤੇ ਮੈਨੂੰ ਕਾਫੀ ਦਿੱਕਤਾਂ ਵੀ ਆਈਆਂ ਸੀ ਜਿਵੇਂ ਹੋਸਟਲ ਦੀ ਛੱਤਾਂ ਛੂੱਤਾਂ ਝੜਦੀਆਂ ਸੀਗੀਆਂ ਅਤੇ ਸਾਫ ਸਫਾਈ ਵੀ ਨਹੀਂ ਇੰਨੀ ਸੀ ਨਾ ਪਾਣੀ ਮਿਲਦਾ ਸੀ ਮਤਲਬ ਅਸੀਂ ਕਾਫੀ ਹੱਦ ਤੱਕ ਅ ਬਹੁਤ ਦਿੱਕਤਾਂ ਦਾ ਸਾਮਣਾ ਕੀਤਾ ਹੈ ਅਤੇ ਮਤਲਬ ਤੈਨੂੰ ਕੋਈ ਇੱਦਾਂ ਦੀ ਪਾਣੀ ਦੀ ਜਾਂ ਕਿਸੇ ਹੋਰ ਚੀਜ਼ ਦੀ ਦਿੱਕਤ ਤਾਂ ਨਹੀਂ ਆ ਰਹੀ ਉੱਥੇ ਅੱਛਾ

ਅੱਛਾ ਅਤੇ ਸਾਡੇ ਟਾਈਮ ਦੇ ਵਿੱਚ ਹੋਸਟਲ ਦੇ ਵਿੱਚ ਸਾਨੂੰ ਸਟਾਈਫਨ ਵਗੈਰਾ ਮਿਲਦਾ ਸੀ ਪਰ ਉਹ ਵੀ ਸਾਨੂੰ ਕਾਫੀ ਦੇਰ ਬਾਅਦ ਆਇਆ ਸੀ ਅਤੇ ਤੈਨੂੰ ਤੁਹਾਨੂੰ ਵੀ ਆ ਆ ਰਿਹਾ ਮੈਨੂੰ ਲੱਗਦਾ ਸਟਾਈਫਨ ਹੈ ਨਾ ਕਿੰਨਾ ਤੇ ਕਿੰਨਾ ਮਿਲ ਰਿਹਾ ਤੁਹਾਨੂੰ ਸਟਾਈਫਨ

ਠੀਕ ਹੈ

ਅੱਛਾ ਠੀਕ ਹੈ ਓਕੇ ਸਤਿ ਸ੍ਰੀ ਅਕਾਲ ਜੀ